ਵੈਸੇ ਤਾਂ ਮੋਬਾਈਲ ਵਿੱਚ ਕਈ ਤਰ੍ਹਾਂ ਦੇ ਐਪ ਹਨ ਕਈ ਤਰ੍ਹਾਂ ਦੇ ਫੰਕਸ਼ਨ ਹਨ ਜਿਵੇਂ ਕਿ ਵਟਸਐਪ ਐਪ ਵਟਸਐਪ ਵਿੱਚ ਹਰ ਤਰ੍ਹਾਂ ਦੀ ਕਾਲਿੰਗ ਹੁੰਦੀ ਏ ਕਿਸੇ ਨਾਲ ਹਾਂ ਵੀ ਵਟਸਐਪ ਵਿੱਚ ਚੈਟ ਕਰੀ ਜਾਂਦੇ ਹਨ ਹਰ ਤਰ੍ਹਾਂ ਦੇ ਦੁੱਖ ਸੁੱਖ ਹੁੰਦੇ ਜਾਂਦੇ ਹਨ ਗੱਲਾਂ ਹੁੰਦੀਆਂ ਹਨ ਅਤੇ ਆਪਾਂ ਜੋ ਮਰਜ਼ੀ ਇੱਕ ਦੂਜੇ ਦੀ ਮੰਨ ਭਾਵ ਨਾਲ ਗੱਲਾਂ ਕਰ ਸਕਦੇ ਹਾਂ ਅਤੇ ਇੰਸਟਾਗ੍ਰਾਮ ਵਿੱਚ ਅਸੀਂ ਚੈਟ ਵੀ ਕਰ ਸਕਦੇ ਹਾਂ ਇੱਕ ਦੂਜੇ ਨੂੰ ਕੋਲਿੰਗ ਵੀ ਸਨੈਪ ਵੀ ਭੇਜ ਸਕਦੇ ਹਨ ਅਤੇ ਜਿੱਦਾਂ ਮਰਜ਼ੀ ਆਪਣੀ ਸੈਲਫੀ ਵਗੈਰਾ ਦੀ ਸਨੈਪ ਵੀ ਖਿੱਚ ਸਕਦੇ ਹਨ ਫੇਸਬੁੱਕ 'ਚ ਤਾਂ ਹਰ ਜਹਾਨ ਦੇ ਬਾਰੇ ਵੇਖ ਸਕਦੇ ਹਨ ਗੱਲਾਂ ਕਰ ਸਕਦੇ ਹਨ ਜਾਣਕਾਰੀ ਲੈ ਸਕਦੇ ਹਨ ਫੇਸਬੁੱਕ ਹਰ ਦੇਸ਼ਾਂ ਦੀ ਹਾਲ ਚਾਲ ਲਈ ਬਣਾਇਆ ਗਿਆ ਏ ਔਰ ਏ ਸਨੈਪਚੈਟ ਫੋਟੋ ਗਲੈਰੀ ਗੈਲਰੀ ਵਿੱਚ ਤਾਂ ਕਈ ਤਰ੍ਹਾਂ ਦੀਆਂ ਸਨੈਪਸ ਨੂੰ ਸੇਵ ਵੀ ਕੀਤਾ ਜਾਂਦਾ ਹੈ ਅਤੇ ਕਈ ਤਰ੍ਹਾਂ ਦੀ ਫੋਟੋਆਂ ਨੂੰ ਸੇਵ ਕੀਤਾ ਜਾਂਦਾ ਹੈ ਅਤੇ ਵਟਸਐਪ ਵਿੱਚ ਹਰ ਤਰ੍ਹਾਂ ਦੇ ਚੈਟ ਕਰਕੇ ਆਪਣੇ ਮਨ ਭਾਉਨੇ ਕੁਸ਼ਚਨ ਆਨਸਰ ਕਰ ਸਕਦੇ ਹਨ ਦਿਲ ਦੀਆਂ ਗੱਲਾਂ ਵੀ ਕਰ ਸਕਦੇ ਹਨ ਅਤੇ ਹੋਰ ਕੀ ਸੀ ਇਹ ਸਭ ਤੋਂ ਵਧੀਆ ਫੇਸਬੁਕ ਇੰਸਟਾਗ੍ਰਾਮ ਸਨੈਪਚੈਟ ਆਦਿ ਕਈ ਸਾਰੇ ਐਪ ਹੁੰਦੇ ਹਨ ਜਿਹਨਾਂ ਨਾਲ ਆਪਾਂ ਇੱਕ ਦੂਸਰੇ ਨਾਲ ਦਿਲ ਦੀਆਂ ਗੱਲਾਂ ਕਰ ਸਕਦੇ ਹਨ